ਅਸੀਂ ਫੋਟੋਗ੍ਰਾਫ਼ੀ ਦਾ ਸ਼ੌਕ ਤਾਂ ਸ਼ੁਰੂ ਤੋਂ ਰੱਖਿਆ ਲੇਕਿਨ ਪੇਸ਼ੇ ਵਜੋਂ ਕਦੀ ਨਹੀਂ ਇਸਦੇ ਬਾਰੇ ਸੋਚਿਆ ਨਾ ਸੋਚਾਂਗੇ ਕਿਉਂਕਿ ਅੱਜ ਕੱਲ੍ਹ ਫੋਟੋ ਲੋਕਾਂ ਲੋਕਾਂ ਤੋਂ ਖਿੱਚਵਾਉਂਦਾ ਕੋਣ ਹੈ ਕੋਈ ਵੀ ਨਹੀਂ ਸਭ ਆਪਣੀ ਫੋਟੋ ਆਪੇ ਹੀ ਖਿੱਚੀ ਜਾਂਦੇ ਹੈ ਪੈਸੇ ਕਿੱਥੇ ਤੋਂ ਕਮਾ ਸਕਦਾ ਬੰਦਾ ਈਵਨ ਵਿਆਹ ਦੀ ਲੋਕ ਫੋਟੋ ਦੀ ਐਂਲਬਮ ਬਣਵਾਉਂਦੇ ਹੈ ਮੇਰਾ ਖਿਆਲ ਨਹੀਂ ਹੈ ਵੀ ਕਿਸੇ ਨੇ ਇੱਕ ਵਾਰ ਤੋਂ ਬਾਅਦ ਕਦੀ ਉਹ ਐਂਲਬਮ ਪਈ ਤਾਂ ਹੋਉਗੀ ਅਲਮੀਰਾ ਦੇ ਵਿੱਚ ਲੇਕਿਨ ਕਿਸੇ ਨੇ ਮੁੜ ਕੇ ਦੇਖੀ ਨਹੀਂ ਹੋਣੀ ਅਤੇ ਸ਼ਾਦੀਆਂ ਦੇ ਵਿੱਚ ਉਹ ਫੋਟੋ ਵੱਲ ਜਿਨ੍ਹਾਂ ਦਾ ਵਿਆਹ ਹੁੰਦਾ ਉਹ ਘੱਟ ਫੋਟੋਆਂ ਖਿੱਚਦੇ ਹੈ ਜਿਹੜੇ ਬਰਾਤੀ ਆਏ ਵੇ ਹੁੰਦੇ ਹੈ ਉਹ ਆਪਣੀ ਜ਼ਿਆਦਾ ਫੋਟੋਆਂ ਖਿੱਚ ਕੇ ਜ਼ਿਆਦਾ ਇੰਨਜੋਅਯ ਕਰਦੇ ਹੈ ਜਿਹੜੇ ਸੀਨ ਉਹਨਾਂ ਨੇ ਫੋਟੋਗ੍ਰਾਫਰਾਂ ਨੇ ਵੀ ਕੈਚ ਨਹੀਂ ਕਰੇ ਹੁੰਦੇ ਉਹ ਸੀਨ ਬਰਾਤੀਆਂ ਦੇ ਕੋਲੋਂ ਮਿਲ ਜਾਂਦੇ ਹੈ ਬਲਕਿ ਇਹ ਪੇਸ਼ਾ ਤਾਂ ਨਹੀਂ ਹੁਣ ਜ਼ਿਆਦਾ ਪ੍ਰਫੁੱਲਿਤ ਹੋ ਸਕਦਾ ਲੇਕਿਨ ਸ਼ੌਕ ਦੇ ਮਾਰੇ ਇਸਦੇ ਵਿੱਚ ਬਹੁਤ ਵਿਕਾਸ ਹੋਇਆ ਔਰ ਇਨਜੋਯੇ ਕਰਦੇ ਹੈ ਲੋਕ ਬੜੇ ਬੜੀਆਂ ਅੱਜ ਕੱਲ਼੍ਹ ਤਾਂ ਮੌਜ਼ ਟਿੱਕਟੋਕ ਯੇ ਛੋਟੇ ਛੋਟੇ ਬੱਚੇ ਆਪਣੀਆਂ ਬੜੇ ਬੜੀਆਂ ਬਣਾ ਕੇ ਫਿਲਮਾਂ ਪਾ ਰਹੇ ਹੈ ਔਰ ਆਪਣੇ ਫੋਲੋਅਰ ਬਣਾ ਰਹੇ ਹੈ ਛੋਟੇ ਛੋਟੇ ਬੱਚੇ ਉਹ ਮੈਨੂੰ ਯਾਦ ਆ ਗਿਆ ਮੇਰੀ ਦੋਹਤੀ ਚੌਥੀ ਪੰਜਵੀਂ ਕਲਾਸ 'ਚ ਪੜ੍ਹਦੀ ਸੀ ਮੈਨੂੰ ਕਹਿੰਦੀ ਨਾਨੂੰ ਮੇਰੇ ਨਾ ਪੈਂਤੀ ਸੌ ਫੇਲੋ ਫੋਲੋਅਰ ਹੋ ਗਏ ਟਿਕਟੋਕ ਪਰ ਉਹ ਮੈਂ ਕਿਹਾ ਯੈਹ ਕਿਯਾ ਹੋਤੇ ਹੈ ਬਈ ਯੇ ਬੱਚੇ ਹੈ ਐਸੇ ਹੀ ਇਸਕਾ ਵਿਕਾਸ ਹੋ ਰਹਾ ਹੈ ਇੰਨਜੋਅਯੇ ਕਰ ਰਹੇ ਹੈ